ਸਾਡੀਆਂ ਸਥਾਨਕ ਖਬਰਾਂ ਨੂੰ ਮੀਡੀਆ ਵਿੱਚ ਕਾਫੀ ਕਵਰੇਜ ਨਹੀਂ ਮਿਲ ਰਹੀ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਦੁਆਰਾ ਫੀਸਾਂ ਵਰਦੀਆਂ ਅਤੇ ਕਿਤਾਬਾਂ ਨੂੰ ਲੈ ਕੇ ਜੋ ਆਮ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ ਉਸ ਬਾਰੇ ਐਡਮਿਸ਼ਨਾਂ ਵੇਲੇ ਸਿਰਫ ਮਾਪੇ ਹੀ ਰੌਲਾ ਪਾਂਦੇ ਰਹਿ ਜਾਂਦੇ ਹਨ ਪਰ ਮੀਡੀਆ ਵੱਲੋਂ ਇਸ ਪ੍ਰਤੀ ਕੋਈ ਬਹੁਤੇ ਸਵਾਲ ਜਵਾਬ ਨਹੀਂ ਚੁੱਕੇ ਜਾਂਦੇ ਸਾਡੇ ਸ਼ਹਿਰ ਸਰਹੰਦ ਦੀ ਸਮੱਸਿਆ ਟ੍ਰੈਫਿਕ ਦੀ ਵੀ ਬਹੁਤ ਵੱਧ ਗਈ ਹੈ ਸ਼ਹਿਰ ਦੇ ਅੰਦਰ ਤਾਂ ਬਹੁਤ ਹੀ ਬੁਰਾ ਹਾਲ ਹੈ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮੀਡੀਆ ਇਸ ਪਾਸੇ ਵੱਲ ਵੀ ਸਰਕਾਰ ਦਾ ਕੋਈ ਧਿਆਨ ਨਹੀਂ ਦਵਾ ਰਿਹਾ